ਆਪਣੇ ਹੱਥੀ ਲਗਾਏ ਹੋਏ ਪੌਦਿਆਂ ਅਤੇ ਰੁੱਖਾਂ ਨੂੰ ਖਿੜਦੇ ਹੋਏ ਦੇਖ ਕੇ ਹਰ ਕਿਸੇ ਦਾ ਮਨ ਗਦ ਗਦ ਹੋ ਉੱਠਦਾ ਹੈ ਇਹ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਸਿਰਫ ਪੌਦੇ ਹੀ ਨਹੀਂ ਜਦੋਂ ਆਪਾਂ ਆਪਣੇ ਹੱਥੀ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਜਦੋਂ ਉਹੀ ਕੰਮ ਸਾਨੂੰ ਅਸੀਂ ਆਪਣੇ ਅੱਖੀ ਪ੍ਰਫੁੱਲਤ ਹੁੰਦੇ ਦੇਖਦੇ ਹਾਂ ਤਾਂ ਅਸੀਂ ਅੰਦਰੋਂ ਅੰਦਰੀ ਬਹੁਤ ਹੀ ਜਿਆਦਾ ਸਕੂਨ ਮਹਿਸੂਸ ਕਰਦੇ ਹਾਂ ਜੇਕਰ ਆਪਾਂ ਰੁੱਖਾਂ ਅਤੇ ਪੌਦਿਆਂ ਦੀ ਗੱਲ ਕਰੀਏ ਤਾਂ ਖਿੜਦੇ ਆਪਣੇ ਹੱਥੀ ਲਗਾਏ ਹੋਏ ਪੌਦਿਆਂ ਨੂੰ ਫੁੱਲਾਂ ਨੂੰ ਖਿੜਦੇ ਹੋਏ ਦੇਖਣਾ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਖੁਸ਼ ਹੁੰਦਿਆਂ ਵੇਖਦੀ ਹੈ ਅਤੇ ਜੋ ਸਕੂਨ ਉਸਨੂੰ ਮਹਿਸੂਸ ਹੁੰਦਾ ਹੈ ਉਹੀ ਸਕੂਨ ਸਾਨੂੰ ਆਪਣੇ ਹੱਥੀ ਲਗਾਏ ਪੌਦਿਆਂ ਤੇ ਰੁੱਖਾਂ ਨੂੰ ਦੇਖ ਕੇ ਹੁੰਦਾ ਹੈ ਇਹ ਸਕੂਨ ਦਾ ਆਉਣਾ ਵੀ ਲਾਜ਼ਮੀ ਆ ਕਿਉਂਕਿ ਅਸੀਂ ਆਪਣਾ ਸਰਵਿਸ ਦਿੱਤਾ ਹੁੰਦਾ ਇਨ੍ਹਾਂ ਰੁੱਖਾਂ ਨੂੰ ਇਨ੍ਹਾਂ ਪੌਦਿਆਂ ਨੂੰ ਇਹਨਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਾਲਿਆ ਹੁੰਦਾ ਹੈ ਤੇ ਆਪਣੇ ਬੱਚਿਆਂ ਨੂੰ ਵੱਧਦਾ ਫੁੱਲਦਾ ਵੇਖ ਕੇ ਹਰੇਕ ਮਾਂ ਬਾਪ ਅੰਦਰੋਂ ਅੰਦਰੀ ਸਕੂਨ ਮਹਿਸੂਸ ਕਰਦਾ ਖੁਸ਼ੀ ਮਹਿਸੂਸ ਕਰਦਾ ਉਸੇ ਹੀ ਤਰ੍ਹਾਂ ਆਪਣੇ ਹੱਥੀ ਲਗਾਏ ਹੋਏ ਪੌਦਿਆਂ ਨੂੰ ਫੁੱਲਾਂ ਨੂੰ ਖਿੜਦੇ ਹੋਏ ਦੇਖ ਕੇ ਵਧਦੇ ਫੁੱਲਦੇ ਦੇਖ ਕੇ ਅਸੀਂ ਅੰਦਰੋਂ ਅੰਦਰੀ ਬਹੁਤ ਹੀ ਜਿਆਦਾ ਸੈਕੂ ਸਕੂਨ ਮਹਿਸੂਸ ਕਰਦੇ ਆਂ ਤੇ ਉਸ ਕੁਦਰਤ ਦਾ ਧੰਨਵਾਦ ਕਰਦੇ ਹਾਂ ਜਿਸਨੇ ਸਾਨੂੰ ਇਹ ਮਾਣ ਬਖਸ਼ਿਆ ਤੇ ਅਸੀਂ ਹਮੇਸ਼ਾ ਉਸ ਕੁਦਰਤ ਦੇ ਰਿਣੀ ਰਹਾਂਗੇ ਜਿਸ ਨੇ ਸਾਨੂੰ ਐਡੀ ਅਮੀਰ ਵਿਰਾਸਤ ਦੇ ਵਿੱਚ ਰੁੱਖ ਪੌਦੇ ਬਨਸਪਤੀ ਦਿੱਤੀ ਹੈ ਸੋ ਧੰਨਵਾਦ